ਭਾਰਤ ਵਿੱਚ ਮੇਰਾ ਮਨਪਸੰਦ ਸਟੇਟ ਪੰਜਾਬ ਹੀ ਹੈ ਕਿਉਂਕਿ ਇੱਥੇ ਸਾਰੀਆਂ ਰੁੱਤਾਂ ਹਨ ਇੱਥੋਂ ਦਾ ਪਾਣੀ ਨਿਰਮਲ ਹੈ ਇੱਥੇ ਦੀ ਧਰਤੀ ਉਪਜਾਊ ਹੈ ਜੇਕਰ ਮੈਂ ਕਿਤੇ ਵੀ ਘੁੰਮਣਾ ਚਾਹਵਾਂਗਾ ਤਾਂ ਸਿਰਫ ਪੰਜਾਬ 'ਚ ਹੀ ਘੁੰਮਣ ਚਾਹਵਾਂਗਾ ਪੰਜਾਬ ਤੋਂ ਬਾਹਰ ਦੇ ਰਾਜ ਮੈਨੂੰ ਓਨੇ ਪਸੰਦ ਨਹੀਂ ਜਿੰਨਾ ਪੰਜਾਬ ਪਸੰਦ ਹੈ